ਮੈਨੂੰ ਇੱਕ ਕਿਤਾਬ ਅਜਿਹੀ ਮਿਲੀ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਤੂੰ ਇੱਕ ਕਿਤਾਬ ਹੈ ਸ਼ਰਾਰਤੀ ਤੱਤ ਉਹ ਪੜ੍ਹ ਉਹ ਕਿਤਾਬ ਮੈਂ ਖਰੀਦ ਕੇ ਲਿਆਂਦੀ ਅਤੇ ਮੈਂ ਉਸ ਨੂੰ ਜਦੋਂ ਪੜ੍ਹਨ ਬੈਠਿਆ ਤਾਂ ਮੇਰਾ ਉਹਦੇ ਵਿੱਚ ਇੰਟਰਸਟ ਨਹੀਂ ਬਣ ਸਕਿਆ ਮੇਰੀ ਰੁਚੀ ਉਹਦੇ ਵਿੱਚ ਨਹੀਂ ਬਣ ਸਕੀ ਮੈਂ ਕਿਉਂਕਿ ਮੈਨੂੰ ਜਿਹੜਾ ਸ਼ੌਂਕ ਹੈ ਥੋੜ੍ਹਾ ਜਿਹਾ ਇਤਿਹਾਸਕ ਚੀਜ਼ਾਂ ਪੜ੍ਹਨ ਦਾ ਰਿਹਾ ਹੈ ਸ਼ੁਰੂ ਤੋਂ ਹੀ ਪਰ ਇਸ ਕਿਤਾਬ ਦੇ ਵਿੱਚ ਸੀਗਾ ਕੋਈ ਮੌਜੂਦਾ ਸਮੇਂ ਦੇ ਆਪਣੀ ਕੋਈ ਜੀਵਨ ਕਥਾ ਲਿਖੀ ਹੋਈ ਸੀ ਜਿਸ ਵਿੱਚ ਕੁਝ ਮਾੜੇ ਚੰਗੇ ਸਮੇਂ ਉਸਨੇ ਲੇਖਕ ਨੇ ਆਪਣੀ ਘਟਨਾ ਦਾ ਜ਼ਿਕਰ ਕੀਤੇ ਹੋਏ ਸਨ ਅਤੇ ਪਰ ਮੈਨੂੰ ਉਹ ਕਿਤਾਬ ਕੋਈ ਜ਼ਿਆਦਾ ਮਤਲਬ ਠੀਕ ਸੀ ਵਧੀਆ ਕਿਤਾਬ ਵਧੀਆ ਸੀ ਪਰ ਮੇਰੀ ਰੁਚੀ ਕਾਰਨ ਜੋ ਮੇਰੀ ਰੁਚੀ ਸੀ ਜਿੱਦਾਂ ਦੀ ਮੇਰੀ ਰੁਚੀ ਸੀਗੀ ਉਸ ਮੁਤਾਬਿਕ ਉਹ ਕਿਤਾਬ ਮੈਨੂੰ ਸਹੀ ਨਹੀਂ ਲੱਗੀ ਅਤੇ ਫਿਰ ਵੀ ਮੈਂ ਨਾ ਚਾਹੁੰਦੇ ਹੋਏ ਵੀ ਅੱਧੀ ਕ ਰੀਡ ਕਰ ਸਕਿਆ ਇਸ ਤੋਂ ਵੱਧ ਮੈਂ ਉਹ ਕਿਤਾਬ ਪੜ੍ਹ ਨਹੀਂ ਸਕਿਆ ਅਤੇ ਇਸ ਕਰਕੇ ਮੈਂ ਜ਼ਿਆਦਾਤਰ ਹਿਸਟੋਰੀਕਲ ਇਤਿਹਾਸਕ ਕਿਤਾਬਾਂ ਹੀ ਪੜ੍ਹਦਾ ਰਹਿੰਦਾ ਹਾਂ ਪਰ ਉਹ ਕਿਤਾਬ ਨੇ ਮੈਨੂੰ ਕਾਫੀ ਜ਼ਿਆਦਾ ਸਮਾਂ ਖਰਾਬ ਕਰਨੇ ਵਾਲੇ ਕੰਮ ਕਰ ਸਕਦੇ ਹਾਂ